ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ

ਹਾ ਹਾਂਜੀ ਹਾਂਜੀ ਬਸੰਤ ਤੋਂ ਬੋਲ ਰਿਹਾਂ ਜੀ ਦੱਸੋ ਜੀ ਕੀ ਕਰ ਸਕਦੇ ਤੁਹਾਡੇ ਲਈ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਇਹ ਪਾਰਟੀ ਦੇ ਵਿੱਚ ਤੁਸੀਂ ਮਤਲਬ ਕਿ ਕਿਆ ਪਸੰਦ ਕਰੋਗੇ ਨੋਨ ਵੈਜ ਵੈਜ ਇਕੱਲਾ ਦੋਵੇਂ ਚੀਜ਼ਾਂ ਜਾਂ ਇਕੱਲਾ ਵੈਜ ਜਾਂ ਇਕੱਲਾ ਨੋਨ ਵੈਜ ਠੀਕ ਠੀਕ ਹੈ ਜੀ ਵੈਜ ਵੈਜ ਦੇ ਵਿੱਚ ਦੇਖੋ ਜੀ ਆਪਣੇ ਕੋਲ ਤੁਸੀਂ ਇਕੱਲੇ ਹੀ ਰੀਫਰੈਸ਼ਮੈਂਟ ਆ ਜਾਂ ਬਾਅਦ ਦੇ ਵਿੱਚ ਡਿਨਰ ਵੀ ਹੈ ਰਾਤ ਦਾ ਹੈ ਜਾਂ ਸਵੇਰ ਦਾ ਪ੍ਰੋਗਰਾਮ ਆਪਣਾ ਅੱਛਾ ਦੁਪਰਿਹਾ ਦਾ ਠੀਕ ਹੈ ਲੰਚ ਟਾਈਮ ਆ ਉਹਦੇ ਵਿੱਚ ਆਪਾਂ ਨੂੰ ਲੰਚ ਹੀ ਆ ਇਕੱਲਾ ਕਿ ਵਿੱਚ ਆਪਣੇ ਰੋਟੀ ਵੀ ਆ ਬਾਅ ਬਾਅਦ ਦੇ ਵਿੱਚ ਠੀਕ ਹੈ ਟੋਟਲ ਪੰਜਾਹ ਆ ਜੀ ਠੀਕ ਹਾਂਜੀ ਓਹਦੇ ਵਿੱਚ ਜੀ ਤੁਹਾਨੂੰ ਪਕੌੜੇ ਪਕੌੜੇ ਵੀ ਦੇਵਾਂਗੇ ਜੀ ਚਾਰ ਤਰ੍ਹਾਂ ਦੇ ਪਕੌੜੇ ਦੇਵਾਂਗੇ ਜੀ ਮੈਕਸ ਪਕੌੜਾ ਹੋਊਗਾ ਵਿੱਚ ਆਲੂ ਫਿੰਗਰ ਹੋਣਗੇ ਗੋਭੀ ਦੇ ਹੋਣਗੇ ਅਤੇ ਨਾਲ ਇੱਕ ਪਨੀਰ ਦੇ ਹੋਣਗੇ ਠੀਕ ਹੈ ਜੀ ਅਤੇ ਨਾਲ ਆਪਾਂ ਜਿਹੜੀ ਰੋਟੀ ਆ ਉਹ ਵੀ ਹੋਊਗੀ ਵਿੱਚ ਰੋਟੀ ਦੋ ਤਰ੍ਹਾਂ ਦੀ ਵਿੱਚ ਸਬਜ਼ੀ ਹੋਊਗੀ ਇੱਕ ਦਾਲ ਹੋਊਗੀ ਜੀ ਅਤੇ ਟੋਟਲ ਆਪਣਾ ਜਿਹੜਾ ਖਰਚਾ ਆ ਢਾਈ ਕੁ ਸੌ ਰੁਪਈਆ ਜਿਹੜਾ ਪਰ ਪਲੇਟ ਦਾ ਹੋਊਗਾ ਜੀ ਦੋਵੇਂ ਚੀਜ਼ਾਂ ਦੇ ਉੱਤੇ ਹਾਂਜੀ ਜੇ ਤੁਸੀਂ ਐਕਸਟਰਾ ਉਹਦੇ ਵਿੱਚ ਕੁਝ ਐਡ ਕਰਨਾ

ਹਾਂਜੀ ਹਾਂਜੀ ਉਹ ਹੀ ਉਹ ਹੀ ਉਹ ਹੀ ਤੁਹਾਨੂੰ ਮੈਂ ਦੱਸਣਾ ਤਾਂ ਜੀ ਜੇ ਕੋਲਡਰਿੰਕ ਆ ਕੋਲਡਰਿੰਕ ਦਾ ਅਲੱਗ ਚਾਰਜ ਆ ਉਹਦੇ ਕੋਲਡਰਿੰਕ ਜਾਂ ਤੁਸੀਂ ਆਪ ਵੀ ਲਿਆ ਕੇ ਸਾਨੂੰ ਦੇ ਸਕਦੇ ਆ ਜਾਂ ਜੇ ਤੁਸੀਂ ਸਾਨੂੰ ਕਰੋਗੇ ਉਹਦੇ ਐਕਸਟਰਾ ਚਾਰਜਿਸ ਹੋਣਗੇ ਜਿੰਨੇ ਵੀ ਪੈਸੇ ਉਹਦੇ 'ਤੇ ਲੱਗਣਗੇ ਉਹ ਤੁਹਾਨੂੰ ਦੱਸ ਦੇਣਗੇ ਇੰਨੀਆਂ ਬੋਤਲਾਂ ਜਿੰਨੀਆਂ ਤੁਸੀਂ ਮੰਗਵਾਓਗੇ ਜੇ ਤੁਸੀਂ ਆਪ ਮੰਗਵਾਉਣੇ ਚਾਹੋ ਆਪ ਮੰਗਵਾ ਸਕਦੇ ਆ ਅਤੇ ਪਲੱਸ ਜਿਹੜੀ ਮਿਠਿਆਈ ਵਗੈਰਾ ਮਿੱਠਾ ਜਿਹਾ ਕੁਝ ਕਰਨਾ ਉਹ ਵੀ ਤੁਹਾਡਾ ਹੀ ਆ ਉਹ ਵੀ ਤੁਸੀਂ ਸਾਨੂੰ ਲਿਆ ਕੇ ਦੇ ਦਿਓ ਜਾਂ ਸਾਨੂੰ ਦੱਸ ਦਿਓ ਵੀ ਆਹ ਮਿੱਠਾ ਮਠਿਆਈ ਚਾਹੀਦੀ ਉਹਦੇ ਜਿਹੜੇ ਚਾਰਜਿਸ ਆ ਉਹ ਅਲੱਗ ਹੋਣਗੇ

ਹਾਂ ਠੀਕ ਹੈ ਠੀਕ ਹੈ ਹਾਂ ਜੀ ਮੈਂ ਤੁਹਾਨੂੰ ਸੈਂਡ ਕਰ ਦਿੰਦਾ ਹਾਂ ਨੰਬਰ ਵੈਸੇ ਇਹ ਹੀ ਹੈ ਮੇਰਾ ਤੁਹਾਨੂੰ ਮੈਂ ਅਡਰੈਸ ਸੈਂਡ ਕਰ ਦਿੰਦਾ ਉੱਥੇ ਬਹਿ ਕੇ ਵਧੀਆ ਗੱਲ ਹੋਜੂਗੀ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ